ਪਰ ਪਿਛਲੇ ਸਾਲ ਹੜ੍ਹ ਆਉਣ ਕਾਰਨ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਬਣ ਗਈ ਅਤੇ ਜਿਸ ਕਾਰਨ ਆਵਾਜਾਲ ਆਵਾਜਾਈ ਲਈ ਬਹੁਤ ਜ਼ਿਆਦਾ ਖੱਜਲ ਖਵਾਰ ਹੋਣਾ ਪੈਂਦਾ ਹੈ ਜਿਵੇਂ ਕਿ ਪਿਛਲੇ ਦਿਨਾਂ ਦੀ ਘਟਨਾ ਹੈ ਮੇਰੀ ਮਾਤਾ ਜੀ ਬਿਮਾਰ ਹੋ ਗਏ ਅਤੇ ਰਾਤ ਦੇ ਕ ਤਕਰੀਬਨ ਦਸ ਵਜੇ ਦਾ ਸਮਾਂ ਹੋ ਰਿਹਾ ਸੀ ਅਤੇ ਅਸੀਂ ਉਹਨਾਂ ਨੂੰ ਗੱਡੀ ਵਿੱਚ ਲੈ ਕੇ ਜਲੰਧਰ ਜਾਣਾ ਸੀ ਪਰ ਕੀ ਹੋਇਆ ਕਿ ਸੜਕ ਦੀ ਹਲਾ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਸਨ ਅਤੇ ਸਾਨੂੰ ਲੈ ਜਾਣ ਵਿੱਚ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਰਸਤੇ ਵਿੱਚ ਸਾਡਾ ਟਾਇਰ ਵੀ ਖਰਾਬ ਹੋ ਗਿਆ ਕਿਉਂਕਿ ਰੋਡਾਂ ਦੀ ਹਾਲਤ ਹਾਲਾਤ ਇੰਨੇ ਜ਼ਿਆਦਾ ਤਰਸਯੋਗ ਹਨ ਕਿ ਰੋੜੇ ਥੱਲੇ ਤੋਂ ਨਿਕਲ ਗਏ ਹਨ ਜੋ ਕਿ ਤਿੱਖੇ ਹਨ ਅਤੇ ਟਾਇਰਾਂ ਵਿੱਚ ਵੱਜਦੇ ਹਨ ਅਤੇ ਟਾਇਰ ਪਾਟ ਜਾਂਦੇ ਹਨ ਅਤੇ ਸਾਨੂੰ ਉੱਥੇ ਤਕਰੀਬਨ ਇੱਕ ਘੰਟਾ ਰੁਕਣਾ ਪੈ ਗਿਆ ਅਤੇ ਅ ਅਸੀਂ ਅੱਗੇ ਜਾ ਕੇ ਹਸਪਤਾਲ ਵਿੱਚ ਪਹੁੰਚੇ ਤਾਂ ਹਸਪਤਾਲ ਵਿੱਚ ਸਿਰਫ ਐਮਰਜੈਂਸੀ ਵਾਰਡ ਹੀ ਖੁੱਲ੍ਹਾ ਸੀ ਰਾਤ ਨੂੰ ਅਤੇ ਅਸੀਂ ਉੱਥੇ ਗਏ ਪਰ ਡਾਕਟਰਾਂ ਦੀ ਅਣਹੋਂਦ ਕਾਰਨ ਮੇਰੇ ਮਾਤਾ ਜੀ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਾਨੂੰ ਉਸੇ ਰਾਤ ਹੀ ਉਹਨਾਂ ਨੂੰ ਜ ਜਲੰਧਰ ਤੋਂ ਚੰਡੀਗੜ੍ਹ ਲੈ ਕੇ ਆਉਣਾ ਪਿਆ ਅਤੇ ਮੈਂ ਸਰਕਾਰ ਤੋਂ ਇਸ ਗੱਲ ਦੀ ਮਦਦ ਦੀ ਮੰਗਦਾ ਹਾਂ ਕਿ ਕਿ ਉਹ ਪਹਿਲਾਂ ਤਾਂ ਸਿਹਤ ਸਹੂਲਤਾਂ ਨੂੰ ਠੀਕ ਕਰਨ ਉਹ ਹਸਪਤਾਲਾਂ ਵਿੱਚ ਨਵੇਂ ਸਟਾਫ ਜਿਵੇਂ ਕਿ ਡਾਕਟਰ ਨਰਸ ਕੰਪਾਊਡਰ ਆਦਿ ਨੂੰ ਭਰਤੀ ਕਰਨ ਅਤੇ ਤਾਂ ਜੋ ਰਾਤ ਨੂੰ ਵੀ ਆਪਣੇ ਸਿਹਤ ਸਹੂਲਤਾਂ ਦੇਣ ਤਾਂ ਕਿ ਜੋ ਨਾਗਰਿਕ ਹੈ ਅਤੇ ਉਹ ਆਪਣੇ ਹਸ ਸਰਕਾਰੀ ਹਸਪਤਾਲ ਵਿੱਚ ਜਾ ਕੇ ਸਿਹਤ ਸੇਵਾਵਾਂ ਲੈ ਸਕਣ ਅਤੇ ਰੋਡਾਂ ਨੂੰ ਠੀਕ ਕਰਨਾ ਚਾਹੀਦਾ ਹੈ ਕਿਉਂਕਿ ਰੋਡ ਜੇ ਟੁੱਟਦੇ ਹਨ ਅਤੇ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਅਸੀਂ ਇੱਕ ਦੂ ਇੱਕ ਜਗ੍ਹਾ ਤੋਂ ਦੂਜੇ ਜਗ੍ਹਾ ਕੰਮ ਕਰਨ ਵੀ ਜਾਣਾ ਹੁੰਦਾ ਹੈ ਅਗਰ ਰੋਡਾਂ ਹੀ ਨਾ ਠੀਕ ਹੋਣ ਤਾਂ ਅਸੀਂ ਆਪਣੇ ਕੰਮ 'ਤੇ ਵੀ ਲੇਟ ਪੁੱਜਾਂਗੇ ਅਤੇ ਇਸ ਕਰਕੇ ਸਾਡੇ ਜੋ ਪੰਜਾਬ ਦੀ ਆਰਥਿਕਤਾ ਹੈ ਅਤੇ ਉਸਨੂੰ ਵੀ ਗਹਿਰੀ ਚੋਟ ਲੱਗੇਗੀ ਅਤੇ ਮੈਂ ਆਸ ਕਰਦਾ ਹਾਂ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ ਸਿੱਖਿਆ ਦੀ ਜੇ ਗੱਲ ਕਰੀਏ ਤਾਂ ਸਿੱਖਿਆ ਵਿੱਚ ਸਰਕਾਰ ਹੁਣ ਬਹੁਤ ਸ਼ਲਾਘਾਯੋਗ ਕੰਮ ਕਰ ਰਹੀ ਹੈ ਪਰ ਥੋੜ੍ਹੇ ਬਹੁਤ ਕੰਮ ਹਜੇ ਵੀ ਬੁਨਿਆਦੀ ਰਹਿੰਦੇ ਹਨ ਜਿਵੇਂ ਕਿ ਸਰਕਾਰੀ ਸਕੂਲਾਂ ਦੀ ਚਾਰ ਦੀਵਾਰੀ ਦਾ ਕੰਮ ਜੋ ਕਿ ਬੱਚੇ ਸਕੂਲ ਵਿੱਚ ਜਦੋਂ ਖੇਡਦੇ ਹਨ ਤਾਂ ਜੋ ਪ੍ਰਾਈਮਰੀ ਸਕੂਲ ਹੈ ਜਾਂ ਸੈਕੰਡਰੀ ਸਕੂਲ ਹੈ ਤਾਂ ਉਸ ਵਿੱਚ ਕੋਈ ਵੀ ਕੰਧ ਨਹੀਂ ਤਾਂ ਬੱਚੇ ਇੱਕ ਦੂਜੇ ਨਾਲ ਲੜ ਭਿੜ ਵੀ ਜਾਂਦੇ ਹਨ ਪਰ ਮੈਨੂੰ ਲੱਗਦਾ ਹੈ ਸਭ ਤੋਂ ਬੁਨਿਆਦੀ ਚੀਜ਼ ਤਾਂ ਇਹ ਪਹਿਲ ਪਹਿਲਾਂ ਤਾਂ ਉਹਨਾਂ ਨੂੰ ਮਿਡ ਡੇ ਮੀਲ ਵਧੀਆ ਮਿਲਣੀ ਚਾਹੀਦੀ ਹੈ ਦੂਜੀ ਉਹਨਾਂ ਨੂੰ ਬੁੱਕਸ ਟਾਈਮ ਸਿਰ ਮਿਲਣੀਆਂ ਚਾਹੀਦੀਆਂ ਅਸੀਂ ਦੇਖਦੇ ਹਾਂ ਕਿ ਸਮੈਸਟਰ ਤਾਂ ਸਾਡਾ ਮਾਰਚ ਵਿੱਚ ਸ਼ੁਰੂ ਹੋ ਜਾਂਦਾ ਹੈ ਪਰ ਜੋ ਬੁੱਕਸ ਆਉਂਦੀਆਂ ਆਉਂਦੀਆਂ ਤਕਰੀਬਨ ਅਗਸਤ ਹੋ ਜਾਂਦਾ ਹੈ ਇਸ ਨਾਲ ਉਹਨਾਂ ਦਾ ਪਹਿਲਾ ਸਮੈਸਟਰ ਵੀ ਪੂਰਾ ਹੋ ਜਾਂਦਾ ਹੈ ਅਤੇ ਉਹਨਾਂ ਦੀ ਪੜ੍ਹਾਈ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ ਅਤੇ ਦੂਜੀ ਗੱਲ ਸਰਕਾਰ ਸਰਕਾਰੀ ਸਕੂਲਾਂ ਦੇ ਆਲੇ ਦੁਆਲੇ ਚਾਰ ਦੀਵਾਰੀ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਵਿੱਚ ਰਹਿਣ ਅਤੇ ਕੋਈ ਵੀ ਸਰਕਾ ਦੁਰਘਟਨਾ ਨਾ ਹੋ ਸਕੇ ਅਤੇ ਮੈਂ ਸਰਕਾਰ ਤੋਂ ਉਮੀਦ ਕਰਦਾ ਹਾਂ ਕਿ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਵੇ